ਹੈਲੋ ਆਪਕਾ ਕੱਪੜੇ ਵਾਲੀ ਦੁਕਾਨ ਪੇ ਸਵਾਗਤ ਹੈ ਮੈਡਮ ਤੁਸੀਂ ਮਤਲਬ ਆਪਣੇ ਹੁਣ ਨਵੀਂ ਸ਼ੋਪ 'ਤੇ ਦੁਕਾਏ ਆ ਸਮਾਨ ਆਪਣੇ ਕੋਲੋਂ ਸਾਰੇ ਤਰੀਕੇ ਦੇ ਮਤਲਬ ਸਾਰੀ ਕੁਆਲਿਟੀ ਦੇ ਕੱਪੜੇ ਮਿਲਦੇ ਆ ਔਰਗਾਜਾ ਹੈ ਮਤਲਬ ਸਿਲਕ ਹੈ ਔਰ ਪਿਓਰ ਸਿਲਕ ਹੈ ਜਾਂ ਸ਼ਿਮਰ ਹੈ ਤੁਸੀਂ ਦੱਸ ਦਿਓ ਕਿਹੜੇ ਮਤਲਬ ਤੁਸੀਂ ਮੰ ਕਿਹੜੇ ਕੱਪੜੇ 'ਚ ਚਾਹੀਦਾ ਏ ਤੁਹਾਨੂੰ ਸੂਟ ਆਪਣੇ ਕੋਲ ਔਰਗਾਂਜਾ ਦੇ ਮੈਮ ਅਲੱਗ ਅਲੱਗ ਕੁਆਲਿਟੀ ਦੇ ਹੈਗੇ ਆ ਲੇਕਿਨ ਆਪਣੇ ਕੋਲ ਦੋ ਹਜ਼ਾਰ ਪਲੱਸ ਤੋਂ ਸਟਾਰਟ ਹੁੰਦੇ ਨੇ ਉਹ ਮੈਡਮ ਤੁਸੀਂ ਆਪਣੇ ਕੋਲ ਸਸਤੇ ਸਸਤਾ ਵੀ ਮਾਲ ਆਉਂਦਾ ਲੇਕਿਨ ਆਪਾਂ ਰੱਖਦੇ ਹੀ ਨਹੀਂ ਉਹਦੀ ਫਿਰ ਸ਼ਿਕਾਇਤ ਕਰਦੇ ਨੇ ਕਸਟਮਰ ਵੀ ਕੱਪੜਾ ਨਿਕਲਿਆ ਨਹੀਂ ਵਧੀਆ ਨਹੀਂ ਨਿਕਲਿਆ ਹੰਢਿਆ ਨਹੀਂ ਆਪਾਂ ਵਧੀਆ ਕੁਆਲਿਟੀ ਦਾ ਰੱਖਦੇ ਆ ਇਹਦੀ ਕੋਈ ਸ਼ਿਕਾਇਤ ਨਹੀਂ ਹੈ ਪੂਰੀ ਗਰੰਟੀ ਹੈ ਕੋਈ ਇਨਦਾ ਕਲਰ ਨਹੀਂ ਜਾਏਗਾ ਜਿੰਨੇ ਵ ਮਰਜੀ ਧੋ ਬਸ ਤੁਹਾਨੂੰ ਡਰਾਈ ਕਲੀਨ ਕਰਾਉਣਾ ਪਏਗਾ ਮੈਡਮ ਪੰਜ ਸੌ ਰੁਪਏ 'ਚ ਮਤਲਬ ਕਾਪੀ ਆਉਂਦੀ ਹੈ ਕੱਪੜੇ ਦੀ ਉਵੇਂ ਦੀ ਆਪਾਂ ਰੱਖਦੀ ਨਹੀਂ ਥੋੜ੍ਹਾ ਜਿਹਾ ਵਧੀਆ ਆਪਾਂ ਪੱਕਾ ਬਿੱਲ ਤੁਹਾਨੂੰ ਕੱਟ ਕੇ ਦਿਆਂਗੇ ਪੂਰਾ ਮਤਲਬ ਆਪਣੇ ਜੀ ਐਸ ਟੀ ਲੱਗ ਕੇ ਆਉਂਦੀ ਆ ਤੁਸੀਂ ਆ ਜੋ ਸ਼ੋਪ 'ਤੇ ਕੋਈ ਗੱਲ ਨਹੀਂ ਆਪਾਂ ਵੇਖ ਲਾਂਗੇ ਤੁਹਾਨੂੰ ਮਤਲਬ ਕਿੰਨੇ ਸੂਟ ਚਾਹੀਦੇ ਕਿੰਨੇ ਆ ਓਕੇ ਮੈਮ ਤੁਸੀਂ ਮਤਲਬ ਦੱਸ ਦਿਓ ਕਿੰਨੇ ਤਰੀਕ ਤੱਕ ਚਾਹੀਦਾ ਤੁਹਾਨੂੰ ਥੋੜ੍ਹੇ ਕਲਰ ਦੱਸ ਦਿਓ ਆਪਾਂ ਲਗਾ ਲਵਾਂਗੇ ਰੇਟ ਦਾ ਤਾਂ ਕੀ ਹੈ ਮੈਡਮ ਸਾਡੇ ਕੋਲ ਕਲਰ ਸਾਰੇ ਤਰ੍ਹਾਂ ਦੀ ਮਿਲ ਜਾਣਗੇ ਜਿਵੇਂ ਦਾ ਤੁਸੀਂ ਕਹੋਗੇ ਫਿਰ ਆਪਾਂ ਉਵੇਂ ਤਰ੍ਹਾਂ ਦਾ ਮਾਲ ਮੰਗਾ ਲਵਾਂਗੇ ਕੋਈ ਆ ਆਪਣੀ ਕੋਈ ਕੁਆਲਿਟੀ 'ਚ ਕੋਈ ਵੀ ਸ਼ਿਕਾਇਤ ਨਹੀਂ ਆਏਗੀ ਮੈਡਮ ਜਿਹੜੇ ਪੰਜ ਪੰਜ ਸੌ ਦੇ ਆ ਉਹ ਤਾਂ ਸ਼ਿਕਾ ਮਤਲਬ ਉਹਨਾਂ ਦਾ ਬੜੀ ਕਸਟਮਰ ਸ਼ਿਕਾਇਤ ਕਰਦੇ ਆ ਅਸੀਂ ਵੀ ਥੋੜ੍ਹਾ ਲੈ ਆ ਵੱਧ ਤੋਂ ਵੱਧ ਆਪਾਂ ਪਰ ਸੂਟ ਫੀਫਟੀ ਪਰਸੈਂਟ ਲੈਸ ਕਰ ਸਕਦੇ ਹਾਂ ਜੇ ਤੁਸੀਂ ਨਹੀਂ ਨਹੀਂ ਤੁਸੀਂ ਪੰਜ ਸੂਟ ਲੈ ਰਹੇ ਹੋ ਤਾਂ ਮੈਡਮ ਪੈਸੇ ਤਾਂ ਲੱਗਦੀ ਹੀ ਹੈ ਦੇਖੋ ਹੁਣ ਕੁਆਲਿਟੀ ਦੇ ਹਿਸਾਬ ਨਾਲ ਹੈ ਅਸੀਂ ਤੁਹਾਨੂੰ ਪੱਕਾ ਬਿੱਲ ਵੀ ਕੱਟ ਕੇ ਉਹ ਜਿੱਥੋਂ ਤੁਸੀਂ ਲਏ ਹੋਣਗੇ ਉਹਨਾਂ ਨੇ ਪੱਕਾ ਬਿੱਲ ਵੀ ਨਹੀਂ ਦਿੱਤਾ ਹੋਣਾ ਅਤੇ ਤੁਸੀਂ ਕੋਈ ਨਾ ਹਾਂਜੀ ਉਹ ਤਾਂ ਹੈ ਬਟ ਸ਼ਿਕਾਇਤ ਨਹੀਂ ਆਉਂਦੀ ਸ਼ਿਕਾਇਤ ਤਾਂ ਬੰਦਾ ਕਰਦਾ ਹੀ ਏ ਮੁੜ ਕੇ ਤੁਸੀਂ ਦੁਕਾਨ 'ਤੇ ਥੋੜ੍ਹੀ ਨਾ ਆਓਗੇ ਕੋਈ ਗੱਲ ਨਹੀਂ ਮੈਡਮ ਤੁਸੀਂ ਦੇਖ ਲਓ ਆਪਾਂ ਵੱਧ ਤੋਂ ਵੱਧ ਸਿਕਸਟੀ ਪਰਸੈਟ ਲੈਸ ਕਰ ਦਾਂਗੇ ਕੋਈ ਨਾ ਤੁਸੀਂ ਪੂਰਾ ਸਾਡੀ ਸ਼ੋਪ 'ਤੇ ਆਏ ਹੋ ਤਾਂ ਅਸੀਂ ਕੋਈ ਗੱਲ ਨਹੀਂ ਤੁਹਾਡਾ ਮਾਨ ਤਾਂ ਰੱਖਾਂਗੇ ਅਸੀਂ ਕਰ ਲਵਾਂਗੇ ਤਾਂ ਕੋਈ ਦੱਸ ਦਿਓ ਸਾਨੂੰ ਕਲਰ ਕਿਹੜੇ ਕਿਹੜੇ ਚਾਹੀਦੇ ਆ ਠੀਕ ਹੈ